ਮੇਰੀ ਜ਼ਿੰਦਗੀ ਦੀ ਸਭ ਤੋਂ ਸੁੰਦਰ ਅਤੇ ਵਿਲੱਖਣ ਜਗ੍ਹਾ ਨੈਣਾ ਦੇਵੀ ਸੀ ਜਿੱਥੇ ਪਹੁੰਚ ਕੇ ਮੈਨੂੰ ਐਵੇਂ ਲੱਗਿਆ ਕਿ ਮੈਂ ਕਿਤੇ ਸਵਰਗ 'ਤੇ ਆ ਗਈ ਹਾਂ ਜਦੋਂ ਮੈਂ ਉਸਦੀ ਚੜ੍ਹਾਈ ਚੜ੍ਹੀ ਤਾਂ ਮੈਨੂੰ ਐਵੇਂ ਮਹਿਸੂਸ ਹੋਇਆ ਕਿ ਜਿਵੇਂ ਮੈਂ ਬੱਦਲਾਂ ਦੇ ਵਿੱਚ ਖੜ੍ਹੀ ਹਾਂ ਜਦੋਂ ਮੈਂ ਉੱਥੇ ਤੋਂ ਨੀਚੇ ਨੂੰ ਪਹਾੜੀਆਂ ਵੱਲ ਦੇਖ ਰਹੀ ਸੀ ਤਾਂ ਉਹ ਪਹਾੜੀਆਂ ਐਨੀਆਂ ਜ਼ਿਆਦਾ ਸੋਹਣੀਆਂ ਲੱਗਦੀਆਂ ਸਨ ਜਿਵੇਂ ਕਿਤੇ ਸ ਸਵਰਗ ਹੋਵੇ